ਮੇਰਾ ਨਾਮ ਨੈੈਨਸੀ ਹੈ ਮੈਂ ਤੁਹਾਨੂੰ ਸਰੋਤਾਂ ਦੀ ਘਾਟ ਦੇ ਸਾਡੇ ਖੇਤਰ ਤੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ ਮੈਂ ਉਹਨਾਂ ਬਾਰੇ ਤੁਹਾਨੂੰ ਕੁਝ ਦੱਸਣਾ ਚਾਹੁੰਦੀ ਹਾਂ ਕਰੋਨਾ ਸਮੇਂ ਸਾਡੇ ਖੇਤਰ ਵਿੱਚ ਹਸਪਤਾਲਾਂ ਦੀ ਘਾਟ ਬਹੁਤ ਸੀ ਜਿਸ ਕਾਰਨ ਸਾਡੇ ਦੇਸ਼ ਦੇ ਖੇਤਰ ਵਿੱਚ ਬਹੁਤ ਪ੍ਰਭਾਵ ਪਿਆ ਕਰੋਨਾ ਸਮੇਂ ਸਾਨੂੰ ਜਦੋਂ ਇੰਜੈਕਸ਼ਨ ਲਗਵਾਉਣ ਲਈ ਜਾਣਾ ਹੁੰਦਾ ਸੀ ਤਾਂ ਸਭ ਤੋਂ ਪਹਿਲਾਂ ਸਾਨੂੰ ਲਾਈਨਾਂ 'ਚ ਖੜ੍ਹੇ ਹੋਣਾ ਪੈਂਦਾ ਸੀ ਅਤੇ ਉੱਥੇ ਤਾਂ ਬੈੱਡ ਵੀ ਬਹੁਤ ਹੀ ਘੱਟ ਸਨ ਜਦੋਂ ਉੱਥੇ ਹਰ ਸਕੂਲ ਜਦੋਂ ਉੱਥੇ ਸਹੂਲਤਾਂ ਨਹੀਂ ਸੀ ਹੁੰਦੀਆਂ ਤਾਂ ਸਾਨੂੰ ਉੱਥੇ ਭੀੜ 'ਚ ਵੀ ਖੜਨਾ ਪੈਂਦਾ ਸੀ ਉੱਥੇ ਸਮੇਂ ਸਿਰ ਦਵਾਈਆਂ ਦਾ ਵੀ ਪ੍ਰਬੰਧ ਨਹੀਂ ਹੁੰਦਾ ਸੀ ਅਤੇ ਇੰਜੈਕਸ਼ਨ ਦੀ ਬਹੁਤ ਘਾਟ ਹੁੰਦੀ ਸੀ ਇੰਜੈਕਸ਼ਨ ਵੀ ਬਹੁਤ ਘੱਟ ਹੁੰਦੇ ਸਨ ਜਦੋਂ ਕਿਸੇ ਨੂੰ ਸਾਹ ਜਾਂ ਹੋਰ ਕੋਈ ਬਿਮਾਰੀ ਹੁੰਦੀ ਸੀ ਤਾਂ ਉਹਨਾਂ ਨੂੰ ਸਮੇਂ ਸਿਰ ਇਲਾਜ ਨਹੀਂ ਮਿਲਦਾ ਸੀ